ਪੌਦਿਆਂ ਲਈ ਵੱਖ ਵੱਖ ਮੌਸਮਾਂ ਦੇ ਅਧਾਰ 'ਤੇ ਸਾਵਧਾਨੀਆਂ ਵੀ ਵੱਖ ਵੱਖ ਹੀ ਹੁੰਦੀਆਂ ਹਨ ਜਿਸ ਤਰਾਂ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਵਧਣ ਕਰਕੇ ਸਾਡੇ ਪੌਦੇ ਜਿਹੜੇ ਆ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਇਸ ਕਰਕੇ ਪੌਦਿਆਂ ਨੂੰ ਛਾਵੇਂ ਰੱਖਣਾ ਜਾਂ ਉਹਨਾਂ ਨੂੰ ਕਿਸੇ ਚਾਦਰ ਦੇ ਹੇਠਾਂ ਰੱਖਿਆ ਜਾਂਦਾ ਹੈ ਕਿ ਉਸ 'ਤੇ ਸਿੱਧੀ ਧੁੱਪ ਨਾ ਪਵੇ ਜਿਸ ਕਾਰਨ ਉਹ ਸੜਨ ਤੋਂ ਬਚ ਸਕਦੇ ਹਨ ਅਤੇ ਉਨ੍ਹਾਂ ਦੇ ਅੰਦਰ ਥੋੜ੍ਹੀ ਜਿਹੀ ਨਮੀ ਜਿਹੜੀ ਆ ਬਣੀ ਰਹੂਗੀ ਬਾਕੀ ਇਹ ਫਿਰ ਆ ਜਾਂਦਾ ਹੈ ਪੱਤਝੜ ਦੇ ਮੌਸਮ ਵਿੱਚ ਪੱਤਝੜ ਦੇ ਮੌਸਮ ਵਿੱਚ ਸਾਰੇ ਪੌਦੇ ਇੱਕ ਵਾਰ ਸੁੱਕ ਜਾਂਦੇ ਹਨ ਪਰ ਉਹਨਾਂ ਨੂੰ ਪਾਣੀ ਹਮੇ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਮੌਸਮ 'ਤੇ ਬਦਲਾਵ ਦੇ ਆਉਣ 'ਤੇ ਉਹਨਾਂ ਦੇ ਨਵੇਂ ਪੱਤੇ ਨਿਕਲ ਸਕਣ ਅਤੇ ਬਾਅਦ ਵਿੱਚ ਸਰਦੀਆਂ ਦੇ ਵਿੱਚ ਵੀ ਪੌਦਿਆਂ ਨੂੰ ਬੜਾ ਸਾਂਭ ਸੰਭਾਲ ਕੇ ਰੱਖਣਾ ਪੈਂਦਾ ਹੈ ਇਹਨਾਂ ਦੇ ਉੱਤੇ ਕੋਹਰੇ ਦਾ ਅਸਰ ਬਹੁਤ ਜ਼ਿਆਦਾ ਪੈਂਦਾ ਹੈ ਜਿਸ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਲੁਕਾ ਕੇ ਰੱਖਣਾ ਪੈਂਦਾ ਉਹਦੇ ਉੱਤੇ ਲਿਫਾਫਾ ਪਾ ਦਿੱਤਾ ਜਾਂਦਾ ਹੈ ਜਾਂ ਕੋਈ ਕੱਪ ਛੱਤ ਹੇਠਾਂ ਰੱਖਿਆ ਜਾਂਦਾ ਜਿਸਦੇ ਕਾਰਨ ਉਹਨਾਂ ਦਾ ਬਚਾਅ ਰਹਿੰਦਾ ਹੈ ਅਤੇ ਕੋਹਰੇ ਤੋਂ ਬਚੇ ਰਹਿੰਦੇ ਹਨ